ਬਰਤਨ ਧੋਣ ਦੀ ਪ੍ਰਕਿਰਿਆ ਵਿੱਚ ਜਿਹੜੇ ਬਰਤਨ ਤੇਲ ਵਾਲੇ ਹੁੰਦੇ ਹਨ ਉਹਨਾਂ ਨੂੰ ਸਭ ਤੋਂ ਪਹਿਲਾਂ ਗਰਮ ਪਾਣੀ ਦੇ ਵਿੱਚੋਂ ਕੱਢਿਆ ਜਾਂਦਾ ਹੈ ਅਤੇ ਫਿਰ ਉਸ ਨੂੰ ਸਰਫ ਦੇ ਨਾਲ ਸਾਫ ਕਰਕੇ ਚੰਗੀ ਤਰ੍ਹਾਂ ਸਿੰਪਲ ਪਾਣੀ ਦੇ ਵਿੱਚ ਧੋ ਦਿੱਤਾ ਜਾਂਦਾ ਹੈ